ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਦੋਨੋਂ ਇੱਕ ਦੂਜੇ ਨਾਲ ਮਿਲ ਕੇ ਬਣੇ ਹੋਏ ਹਨ ਜਿਨਾਂ ਕਰਕੇ ਪੰਜਾਬ ਹੈ ਪੰਜਾਬ ਇਨ ਦੋਹਾਂ ਦੀ ਮੌਜੂਦਗੀ ਨਾਲ ਹੀ ਬਣਿਆ ਚੱਲਦਾ ਹੈ ਜਿਸ ਕਰਕੇ ਸੱਭਿਆਚਾਰ ਦਾ ਤਾਂ ਬਹੁਤ ਹੀ ਮਹੱਤਵਪੂਰਨ ਮਹੱਤਵ ਹੈ ਜਿਸ ਕਰਕੇ ਇਹਨੂੰ ਖੁੱਲ੍ਹ ਕੇ ਅਸੀਂ ਜੀਅ ਸਕਦੇ ਹਨ ਪੰਜਾਬੀ ਸੱਭਿਆਚਾਰ ਦੇ ਪ੍ਰੋਗਰਾਮ ਬਾਹਰਲੇ ਦੇਸਾਂ 'ਚ ਵੀ ਹੁੰਦੇ ਹਨ ਪੰਜਾਬ 'ਚ ਵੀ ਹੁੰਦੇ ਹਨ ਜਿਸ ਕਰਕੇ ਬੰਦਾ ਖੁੱਲ੍ਹ ਕੇ ਜੀਅ ਸਕਦਾ ਹੈ ਇਹਦੇ ਨਾਲ ਅਤੇ ਪੰਜਾਬੀ ਭਾਸ਼ਾ ਇਦਾਂ ਦੀ ਹੈ ਬੰਦਾ ਖੁੱਲ੍ਹ ਕੇ ਬੋਲ ਸਕਦਾ ਹੈ ਅਤੇ ਖੁੱਲ੍ਹ ਕੇ ਸਮਝ ਸਕਦਾ ਹੈ ਇਸਦੇ ਦੋ ਦੋ ਮਤਲਬ ਵੀ ਨਿਕਲਦੇ ਹਨ ਜੇ ਬੰਦਾ ਪੰਜਾਬੀ 'ਚ ਸਮਝੇ ਬੋਲੇਗੀ 'ਤੇ ਕੋਈ ਬੰਦਾ ਗਲਤ ਸਮਝਦਾ ਇਹਦਾ ਮਤਲਬ ਕੋਈ ਬੰਦਾ ਠੀਕ ਸਮਝਦਾ ਹੈ ਜੋ ਬੰਦਾ ਸਹੀ ਹੈ ਉਹਦਾ ਮਤਲਬ ਸਹੀ ਸਮਝਦਾ ਜੋ ਬੰਦਾ ਗਲਤ ਹੈ ਉਹਦਾ ਮਤਲਬ ਗਲਤ ਸਮਝਦਾ ਹੈ ਪਰ ਸੱਭਿਆਚਾਰ ਪੰਜਾਬ ਚ ਬਹੁਤ ਜਿਆਦਾ ਮਹੱਤਵਪੂਰਨ ਇਸ ਕਰਕੇ ਬੰਦਾ ਖੁੱਲ੍ਹ ਕੇ ਜੀਅ ਰਿਹਾ ਇਸ ਨੂੰ ਇਸ ਦੇ ਨਾਲ ਬੰਦਾ ਆਪਣੇ ਮਨਪਸੰਦ ਨਾਲ ਬੰਦਾ ਬੋਲ ਸਕਦਾ ਆਪਣੇ ਮਨ ਪਸੰਦ ਨਾਲ ਪ੍ਰੋਗਰਾਮ ਕਰ ਸਕਦਾ ਹੈ